ਮੈਂ ਖਰੀਦਦਾਰੀ ਲਈ ਆਪਣੇ ਨੇੜੇ ਦੇ ਮੋਲ ਵਿੱਚ ਗਿਆ ਮੈਨੂੰ ਉੱਥੋਂ ਜੋ ਜੋ ਚੀਜ਼ਾਂ ਚਾਹੀਦੀਆਂ ਸੀ ਮੈਂ ਉਹ ਚੀਜ਼ਾਂ ਲੈ ਕੇ ਬਿੱਲ ਕਟਾਉਣ ਲਈ ਕਾਊਂਟਰ 'ਤੇ ਗਿਆ ਜਿਹੜਾ ਉੱਥੇ ਬੰਦਾ ਬਿੱਲ ਕੱਟਦਾ ਸੀ ਉਹ ਹੋਰ ਪਾਸੇ ਦਾ ਰਹਿਣ ਵਾਲਾ ਸੀ ਉਸ ਨੂੰ ਪੰਜਾਬੀ ਨਹੀਂ ਆਉਂਦੀ ਸੀ ਅਤੇ ਮੈਨੂੰ ਉਹ ਕਹਿੰਦਾ ਕਿ ਤੁਸੀਂ ਇਸ ਦੀ ਜਾਣਕਾਰੀ ਮੈਨੂੰ ਹਿੰਦੀ ਵਿੱਚ ਦੇ ਦਿਉ ਮੈਂ ਉਸਨੂੰ ਸਾਰੀ ਜਾਣਕਾਰੀ ਹਿੰਦੀ ਜੋ ਕਿ ਮੇਰੇ ਕੋਲ ਸਮਾਨ ਸੀ ਉਸ ਨੂੰ ਹਿੰਦੀ ਵਿੱਚ ਦੱਸਿਆ ਅਤੇ ਉਸਨੇ ਬਿੱਲ ਕੱਟ ਕੇ ਮੇਰਾ ਧੰਨਵਾਦ ਕੀਤਾ ਅਤੇ ਮੈਨ ਮੈਨੂੰ ਇਹ ਅਨੁਭਵ ਬਹੁਤ ਹੀ ਵਧੀਆ ਲੱਗਿਆ